ਹਾਂਜੀ ਸ਼੍ਰੀਮਾਨ ਜੀ ਆਪਣਾ ਪਿੱਛੇ ਜੇ ਅਸੀਂ ਫੁਰਸਤ ਢਾਬੇ ਦੇ ਵਿੱਚ ਖਾਣਾ ਖਾਧਾ ਸੀ ਸਾਨੂੰ ਤੁਹਾਡੀ ਜਿਹੜਾ ਖਾਣਾ ਬੜਾ ਪਸੰਦ ਆਇਆ ਖਾਸ ਕਰਕੇ ਜਿਹੜੀਆਂ ਤੁਸੀਂ ਤੰਦੂਰ ਦੇ ਉੱਤੇ ਰੋਟੀਆਂ ਬ ਬਣਾਈਆਂ ਉਹ ਦੂਜੀਆਂ ਆਮ ਢਾਬਿਆਂ ਨਾਲੋਂ ਬਹੁਤ ਜ਼ਿਆਦੇ ਬੈਟਰ ਸੀਗੀਆਂ ਇਸ ਕਰਕੇ ਅਸੀਂ ਦੁਬਾਰਾ ਤੁਹਾਨੂੰ ਔਡਰ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਤੁਸੀਂ ਕਿਰਪਾ ਕਰਕੇ ਅਸੀਂ ਤੁਹਾਡੇ ਆਪਣਾ ਢਾਬੇ ਤੋਂ ਅਸੀਂ ਮੰਗਵਾਉਣਾ ਚਾਹੁੰਦੇ ਹਾਂ ਸਾਨੂੰ ਦੋ ਫੁੱਲ ਪਲੇਟਾਂ ਇੱਕ ਦਾਲ ਮੱਖਣੀ ਦੀ ਇੱਕ ਸ਼ਾਹੀ ਪਨੀਰ ਦੀ ਅਤੇ ਕਿਰਪਾ ਕਰਕੇ ਨਾਲ ਬਾਰ੍ਹਾਂ ਫੁਲਕੇ ਜਿਹੜੇ ਹੈਗੇ ਹੈ ਉਹ ਸਾਨੂੰ ਤੁਸੀਂ ਦੇਣ ਦੀ ਕਿਰਪਾਲਤਾ ਕਰੋ ਜੀ ਧੰਨਵਾਦ